ਹੈਲੋ ਹਾਂਜੀ ਹਾਂਜੀ ਹਾਂ ਮੇਰੇ ਮਨ 'ਚ ਵੀ ਇਹ ਸੀ ਮੈਂ ਕਿਹਾ ਬੱਚੇ ਨੂੰ ਨਾਲ ਲਿਜਾ ਕੇ ਇੱਕ ਵਾਰ ਵਿਖਾ ਦਿੰਦੇ ਸਾਰੇ ਸਕੂਲ ਮਰਜ਼ੀ ਦਾ ਪਸੰਦ ਵਾਲਾ ਹੋਵੇ ਪਰ ਚਲੋ ਫਿਰ ਵੀ ਡਿਸਾਈਡ ਨਹੀਂ ਕਰਨਾ ਵੀ ਚਲੋ ਪੰਜ ਮਿੰਨਟ 'ਚ ਇੰਨਾ ਕੁ ਹੁੰਦਾ ਵੀ ਤੇ ਜੇ ਇੱਕ ਨਿਗ੍ਹਾ ਮਾਰਵਾ ਵੀ ਗਏ ਤਾਂ ਬੱਚਾ ਕਈ ਵਾਰ ਪਸੰਦ ਕਰਦਾ ਕਿ ਇਹ ਮੇਰਾ ਸਕੂਲ ਹੈਗਾ ਵੈਸੇ ਆਪਣੇ ਫ਼ਾਜ਼ਿਲਕਾ 'ਚ ਸਕੂਲ ਅੱਛੇ ਅੱਛੇ ਹੈਗੇ ਨੇ ਹੋਲੀ ਹਾਲਟ ਨੇ ਆਤਮ ਵੱਲਭ ਹਾਂ ਅਤੇ ਸਰਵਹਿਤਕਾਰੀ ਸਕੂਲ ਹੈ ਡੀ ਏ ਵੀ ਠੀਕ ਹੈ ਹਾਂ ਡੀ ਸੀ ਮੋਡਲ ਸਕੂਲ ਇਹ ਵੀ ਠੀਕ ਹੈ ਕੋਨਵੈਂਟ ਵੀ ਹੈਗਾ ਇੱਕ ਹੋਰ ਵੀ ਨਵਾਂ ਸਕੂਲ ਖੁੱਲ੍ਹਿਆ ਫੌਜੀਆਂ ਦਾ ਤਾਂ ਹੈਗਾ ਹੀ ਹੈ ਆਰਮੀ ਸਕੂਲ ਉਹਦੇ ਨਾਲ ਇੱਕ ਇੱਕ ਬੀ ਐੱਸ ਐੱਫ ਨੇ ਨਵਾਂ ਸਕੂਲ ਖੋਲ੍ਹਿਆ ਅਤੇ ਕੇਂਦਰੀ ਵਿਦਿਆਲਿਆ ਹਾਂ ਉਹ ਸੌਖਾ ਥੋੜ੍ਹਾ ਜਿਹਾ ਵੀ ਉਹ ਹਾਂ ਉਹਨਾਂ ਕੋਲ ਗੱਡੀਆਂ ਬਹੁਤ ਵਧੀਆ ਨੇ ਅਤੇ ਮਿਲਟ ਇਨ੍ਹਾਂ ਬੀ ਐਸ ਐਫ ਵਾਲੇ ਜਵਾਨਾਂ ਦੇ ਪਹਿਰੇ 'ਚ ਜੇ ਬੱਚੇ ਲੈ ਜਾਂਦੇ ਨੇ ਉਹ ਹੀ ਘਰਾਂ 'ਚ ਛੱਡ ਜਾਂਦੇ ਨੇ ਅਤੇ ਪੜ੍ਹਾਈ ਵੀ ਉੱਥੇ ਪੂਰੀ ਸਖਤੀ ਟਾਈਮ ਵੀ ਪੂਰਾ ਦਿੰਦੇ ਨੇ ਫਿਰ ਉੱਥੇ ਕਈ ਵਾਰ ਇਹ ਕਈ ਬੱਚਾ ਅੱਗੇ ਨਿਕਲ ਜਾਵੇ ਤਾਂ ਉਹਨੂੰ ਅੱਗੇ ਪੜ੍ਹਨ ਵਿਚ ਵੀ ਮਦਦ ਕਰਦੇ ਨੇ ਅਤੇ ਨੌਕਰੀ ਮਿਲਣੇ 'ਚ ਵੀ ਮਦਦ ਕਰਦੇ ਨੇ ਕੁਛ ਬੱਚੇ ਇੱਥੋ ਨਿਕਲੇ ਨੇ ਫ਼ਾਜ਼ਿਲਕਾ ਦੇ ਆਪਣੇ ਉਹ ਪਰਿਵਾਰ ਹੈਗਾ ਅਤੇ ਉਹ ਕੰਚਨਵਰੀ ਜਿਹੜੇ ਨੇ ਉਹ ਵੀ ਇਹਨਾਂ ਦੀ ਭਾਬੀ ਠਠੱਈ ਠਠੱਈ ਨੇ ਜਿਹੜੇ ਉਹਨਾਂ ਦੇ ਦੋਨੋਂ ਬੱਚੇ ਉਹ ਸਲੈਕਸ਼ਨ ਹੋ ਗਈ ਨਾ ਉਹਨਾਂ ਦੀ ਬਾਹਰ ਅਤੇ ਹਾਂ ਉਹ ਇਸ ਬੇਸ 'ਤੇ ਹੋਈ ਹੈ ਇੱਕ ਉਦੈਪੁਰ ਹੈਗਾ ਸ਼ਾਇਦ ਇੱਕ ਕਿਸੇ ਹੋਰ ਜਗ੍ਹਾ ਕਪੂਰਥਲਾ ਜਾਂ ਜਲੰਧਰ 'ਚ ਹਾਂ ਬਿਲਕੁਲ ਹਾਂ ਬੀ ਐਸ ਐਫ ਵਾਲਿਆਂ ਨਾਲ ਤਾਂ ਚੱਲੋ ਹਾਂ ਬੀ ਐਸ ਐਫ ਦਾ ਆਰਮੀ ਅਤੇ ਇੱਕ ਇੱਥੇ ਹੋਰ ਸਰਕਾਰ ਨੇ ਖੋਲ੍ਹਿਆ ਆਪਣੇ ਪੰਜ ਛੇ ਕਿਲੋਮੀਟਰ 'ਤੇ ਨਵੋਦਿਆ ਸਕੂਲ ਨ ਨਵੋਦਿਆ ਸਕੂਲ ਹਾਂ ਨਵੋਦਿਆ ਦਾ ਵੀ ਸਕੂਲ ਹਾਂ ਉੱਥੇ ਵੀ ਉਹਨਾਂ ਨੇ ਪੂਰਾ ਐਂ ਮਤਲਬ ਹੋਸਟਲ ਵੀ ਹੈ ਬੱਚੇ ਨੂੰ ਮਹੀਨਾ ਮਹੀਨਾ ਨਹੀਂ ਘਰ ਜਾਣ ਦਿੰਦੇ ਉਹ ਉੱਥੇ ਹੀ ਸਾਰੇ ਅੰਦਰ ਬੈਡਮਿੰਟਨ ਵਗੈਰਾ ਜੋ ਵੀ ਉਹਦੀ ਸ਼ੌਂਕ ਨੇ ਉਹ ਸਾਰੇ ਉੱਥੇ ਹੀ ਪੂਰੇ ਹੋ ਜਾਂਦੇ ਨੇ ਅਤੇ ਜੈਨੀਆਂ ਨੇ ਵੀ ਬਹੁਤ ਅੱਛੇ ਸਕੂਲ ਖੋਲ੍ਹੇ ਨੇ ਇਹ ਆਪਣੇ ਨਾਲ ਹੀ ਇੱਥੇ ਮਲੋਟ ਰੋਡ 'ਤੇ ਇਹ ਵੀ ਸਕੂਲ ਖੋਲ੍ਹਿਆ ਇਹ ਵੀ ਸਕੂਲ ਵੇਖਣ ਵਾਲਾ ਬਹੁਤ ਅੱਛਾ ਗਰੀਨਰੀ ਬਹੁਤ ਵਧੀਆ ਅਤੇ ਆਪਾਂ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਓਕੇ